ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਵਿੱਚ ਸਰਕਾਰ ਦੁਆਰਾ ਕਾਫੀ ਸਮਾਜ ਭਲਾਈ ਅਤੇ ਵਿਕਾਸ ਪ੍ਰੋਗਰਾਮ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ ਸਭ ਤੋਂ ਪਹਿਲੀ ਚੀਜ਼ ਹੈ ਸਿੱਖਿਆ ਸਿੱਖਿਆ ਖੇਤਰ ਵਿੱਚ ਸਟੂਡੈਂਟਾਂ ਨੂੰ ਉਹਨਾਂ ਦੀ ਫੀਸਾਂ ਵਿੱਚ ਕਟੌਤੀ ਦਿੱਤੀ ਜਾ ਰਹੀ ਹੈ ਅਤੇ ਫਿਰ ਗਰੀਬੀ ਘਟਾਉਣ ਵਾਲੇ ਖੇਤਰ ਗਰੀਬੀ ਘਟਾਉਣ ਵਾਲੇ ਦੇ ਵਿੱਚ ਹੀ ਜਿਵੇਂ ਨੌਜਵਾਨ ਅੱਜ ਕੱਲ੍ਹ ਦੇ ਨੌਜਵਾਨਾਂ ਨੂੰ ਰੁਜ਼ਗਾਰ ਦਿੱਤੇ ਜਾ ਰਹੇ ਹਨ ਅਤੇ ਔਰਤਾਂ ਨੂੰ ਇੱਕ ਬਹੁਤ ਹੀ ਵਧੀਆ ਫਾਇਦਾ ਦਿੱਤਾ ਜਾ ਰਿਹਾ ਜਿਹਨਾਂ ਵਿੱਚ ਕਿ ਉਹਨਾਂ ਨੂੰ ਟਰੈਵਲਿੰਗ ਦਾ ਕਿਰਾਇਆ ਨਹੀਂ ਦੇਣਾ ਪੈਂਦਾ ਇਹ ਚੀਜ਼ ਉਹਨਾਂ ਨੂੰ ਬਹੁਤ ਹੀ ਚੰਗੀ ਲੱਗੀ ਅਤੇ ਹੋਰ ਵੀ ਕਾਫੀ ਚੀਜ਼ਾਂ ਹਨ ਜੋ ਕਿ ਸਰਕਾਰ ਦੁਆਰਾ ਹੁਣ ਲਾਗੂ ਕੀਤੀਆਂ ਜਾ ਰਹੀਆਂ ਹਨ ਚਲਾਈਆਂ ਜਾ ਰਹੀਆਂ ਹਨ ਜਿਹਨਾਂ ਜਿਹਨਾਂ ਨਾਲ ਕਿ ਹੁਣ ਦੇ ਲੋਕ ਫਾਇਦਾ ਲੈ ਸਕਣ ਅਤੇ ਆਪਣੇ ਸਮਾਜ ਵਿੱਚ ਅੱਗੇ ਵੱਧ ਸਕਣ